ਜਦੋਂ ਸਾਡੇ ਮਤਲਬ ਪੰਜਾਬੀਆਂ ਦੇ ਜਾਂ ਕਿਸੇ ਵੀ ਧਰਮ 'ਚ ਸਿੱਖ ਧਰਮ 'ਚ ਜਾਂ ਹਿੰਦੂ ਧਰਮ 'ਚ ਕੋਈ ਵੀ ਮਤਲਬ ਜਵਾਕ ਜਨਮ ਲੈਂਦਾ ਹੈ ਨਾ ਮਤਲਬ ਜਵਾਕ ਨੂੰ ਜਦੋਂ ਜਨਮ ਲੈਂਦਾ ਕੋਈ ਨਾ ਕੋਈ ਮਤਲਬ ਉਹਨੂੰ ਕੋਈ ਉਹਦੇ ਮੂੰਹ 'ਚ ਚੀਜ਼ ਪਾਉਂਦਾ ਮਿੱਠੀ ਚੀਜ਼ ਹੈ ਨਾ ਅਤੇ ਸਾਡੇ ਮਤਲਬ ਉਹਨੂੰ ਜਿਹਨੂੰ ਮਤਲਬ ਪੰਜਾਬੀ 'ਚ ਗੁੜ੍ਹਤੀ ਦਾ ਸ਼ਬਦ ਦਿੱਤਾ ਗਿਆ ਹੈ ਨਾ ਗੁੜ੍ਹਤੀ ਨਾਮ ਦਿੱਤਾ ਗਿਆ ਗੁੜ੍ਹਤੀ ਤੋਂ ਬਾਅਦ ਕੀ ਹੈ ਮਤਲਬ ਜਦੋਂ ਵੀ ਬੱਚਾ ਹੌਸਪੀਟਲ ਹੈ ਜਾਂ ਕੁਛ ਵੀ ਹੈ ਹੈ ਨਾ ਉਹਨੂੰ ਡੋਕਟਰ ਜਦੋਂ ਦੋ ਤਿੰਨ ਦਿਨ ਚਾਰ ਪੰਜ ਦਿਨ ਬਾਅਦ ਛੁੱਟੀ ਮਿਲ ਜਾਂਦੀ ਹੈ ਨਾ ਤਾਂ ਇਸ ਤੋਂ ਬਾਅਦ ਜਿਹੜਾ ਉਹ ਹੁੰਦਾ ਮਤਲਬ ਉਹਨੂੰ ਘਰ ਲਿਆਉਂਦੇ ਹੈ ਘਰ ਲਿਆਉਣ ਤੋਂ ਬਾਅਦ ਉਹਦੇ ਮਤਲਬ ਕਾਲਾ ਧਾਗਾ ਬੰਨ ਦਿੱਤਾ ਜਾਂਦਾ ਹੈ ਅਤੇ ਉਹਦੇ ਵਿੱਚ ਕੀ ਹੈ ਮਤਲਬ ਜਵਾਕ ਨੂੰ ਕੋਈ ਨਜ਼ਰ ਵਗੈਰਾ ਨਾ ਲੱਗੇ ਹੈ ਨਾ ਅਤੇ ਇਸ ਤੋਂ ਬਾਅਦ ਕੀ ਹੈ ਮਤਲਬ ਉਹਨੂੰ ਇੱਕੀ ਦਿਨ ਜਾਂ ਸਾਡੇ ਹਿੰਦੂ ਧਰਮ 'ਚ ਸੱਤ ਦਿਨਾਂ ਬਾਅਦ ਉਹਨੂੰ ਨਾਮਕਰਣ ਕੀਤਾ ਜਾਂਦਾ ਵੀ ਕਿਹੜੇ ਅਕਸ਼ਰ 'ਤੇ ਨਾਮ ਲਿਖਿਆ ਜਾਵੇ ਜਾਂ ਕੀ ਨਾਮ ਰੱਖਣਾ ਉਹਦਾ ਜਾਂ ਕਿਹੜਾ ਵਰਡ ਲਿਖਿਆ ਜਾਵੇ ਹੈ ਨਾ ਅਲੱਗ ਪੰਜ ਛੇ ਵਰਡ ਹੁੰਦੇ ਹੈ ਨਾ ਇਸ ਤੋਂ ਬਾਅਦ ਕੀ ਆ ਮਤਲਬ ਉਹਨੂੰ ਗਿਆਰਾਂ ਜਾਂ ਇੱਕੀ ਦਿਨ ਮਤਲਬ ਕੋਈ ਘਰ ਨਾ ਆਵੇ ਆਵਾਜ਼ ਮਾਰ ਕੇ ਮਤਲਬ ਇੱਦਾਂ ਨਾ ਆਵੇ ਹੈਨਾ ਘਰ ਬਸ ਇਹ ਚੀਜ਼ ਦਾ ਪ੍ਰਹੇਜ਼ ਰੱਖਿਆ ਜਾਂਦਾ ਅਤੇ ਕਾਲਾ ਧਾਗਾ ਜਵਾਕ ਨੂੰ ਮਤਲਬ ਇਸ ਕਰਕੇ ਬੰਨ੍ਹਿਆ ਜਾਂਦਾ ਕਿਉਕਿ ਨਜ਼ਰ ਵਗੈਰਾ ਨਾ ਲੱਗੇ ਉਹਨੂੰ ਹੈ ਨਾ ਤਾਂ ਕਰਕੇ ਪੰਜਾਬੀ 'ਚ ਇਹ ਹੀ ਹੁੰਦਾ ਵੀ ਨਜ਼ਰ ਤੋਂ ਜ਼ਿਆਦਾ ਮਤਲਬ ਪਰਹੇਜ ਰੱਖਦੇ ਹੈ ਵੀ ਨਜ਼ਰ ਨਾ ਲੱਗ ਜੇ ਕੀਤੇ ਜਵਾਕ ਨੂੰ ਜਿਹਦੇ ਨਾਲ ਜਵਾਕ ਨੂੰ ਬਿਮਾਰ ਹੋਣ ਦਾ ਡਰ ਰਹਿੰਦਾ ਜਾਂ ਕੁਛ ਵੀ ਹੈ ਅਤੇ ਮਤਲਬ ਸਾਡੇ ਪੰਜਾਬ 'ਚ ਇੱਦਾਂ ਦਾ ਕੁਝ ਕੀਤਾ ਜਾਂਦਾ ਹੈ ਨਾ ਹਾਂਜੀ ਥੈਂਕ ਯੂ